ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਐਪ ਤੋਂ ਇੱਕ ਪਰਸ ਦਾ ਆਰਡਰ ਦਿੱਤਾ ਸੀ ਅਤੇ ਉਹ ਮੈਨੂੰ ਕੱਲ੍ਹ ਮਿਲ ਗਿਆ ਉਹ ਪਰਸ ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਉਸਦਾ ਰੰਗ ਵੀ ਬਹੁਤ ਵਧੀਆ ਹੈ ਅਤੇ ਸਾਈਜ਼ ਵੀ ਜੋ ਮੈਨੂੰ ਚਾਹੀਦਾ ਸੀ ਉੱਥੇ ਅਕੋਡਿੰਗ ਹੀ ਹੈ ਜਦੋਂ ਮੈ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸਦੀ ਕਪੈਸਿਟੀ ਵੀ ਬਹੁਤ ਹੈ ਜਿਸ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਮਾਨ ਰੱਖਿਆ ਜਾ ਸਕਦਾ ਹੈ ਅਸਲ ਵਿੱਚ ਮੇਰੇ ਘਰ ਕੁਝ ਰਿਸ਼ਤੇਦਾਰ ਵੀ ਆਏ ਹੋਏ ਸਨ ਉਹਨਾਂ ਨੂੰ ਵੀ ਉਹ ਪਰਸ ਬਹੁਤ ਪਸੰਦ ਆਇਆ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਲਈ ਵੀ ਇਸਦਾ ਆਰਡਰ ਕਰ ਅਤੇ ਸਾਨੂੰ ਵੀ ਇਹ ਪਰਸ ਮੰਗਵਾ ਕੇ ਦੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਪਹਿਲੀ ਵਾਰ ਆਰਡਰ ਕੀਤਾ ਸੀ ਅਤੇ ਉਹ ਚੀਜ਼ ਬਹੁਤ ਵਧੀਆ ਆਈ ਅਤੇ ਅੱਗੇ ਤੋਂ ਵੀ ਮੈਂ ਤੁਹਾਡੀ ਐਪ ਤੋਂ ਚੀਜ਼ਾਂ ਮੰਗਵਾਉਂਦੀ ਰਹਾਂਗੀ ਧੰਨਵਾਦ